ਬਾਰ੍ਹਾਂ ਅਕਤੂਬਰ ਉੱਨੀ ਸੌ ਪਚਾਸੀ ਨੌ ਜੁਲਾਈ ਉੱਨੀ ਸੌ ਚੁਰਾਸੀ ਛੇ ਫਰਵਰੀ ਉੱਨੀ ਸੌ ਬਿਆਸੀ ਦਸ ਅਪ੍ਰੈਲ ਦੋ ਹਜ਼ਾਰ ਤੇਰ੍ਹਾਂ ਦਸ ਜਨਵਰੀ ਦੋ ਹਜ਼ਾਰ ਚੌਵੀ